ਹੈਲੋ ਹੈਲੋ ਮੈਂ ਪਲਕ ਹਾਂਜੀ ਅਤੇ ਮੈਂ ਜਲੰਧਰ ਤੋਂ ਆਈ ਹਾਂ ਹਾਂਜੀ ਅਤੇ ਮੈਂ ਤੁਹਾਡੇ ਤੋਂ ਪੁੱਛਣਾ ਸੀਗਾ ਕਿ ਫੇਮਸ ਢਾਬੇ ਕਿਹੜੇ ਕਿਹੜੇ ਹੁਸ਼ਿਆਰਪੁਰ ਵਿੱਚ ਹਾਂਜੀ ਅੱਛਾ ਅਤੇ ਇਹਨਾਂ ਦਾ ਮੈਨਿਊ ਅੱਛਾ ਕਿਆ ਪ੍ਰਾਈਜ਼ ਵਗੈਰਾ ਮਤਲਬ ਅੱਛਾ ਸਟਾਫ ਵਗੈਰਾ ਅੱਛਾ ਅੱਛਾ ਹੋਰ ਮੈਂ ਜਲੰਧਰ ਤੋਂ ਆਈ ਇੱਥੇ ਮਤਲਬ ਮੈਂ ਫੇਮਸ ਢਾਬੇ ਹੁਸ਼ਿਆਰਪੁਰ ਦੇਖਣੇ ਸੀ ਪਰ ਮੈਨੂੰ ਤੁਹਾਡਾ ਕਾਂਟੈਕਟ ਅਵੇਲੇਬਲ ਹੋਇਆ ਦੈਨ ਤੁਹਾਨੂੰ ਕਾਲ ਕੀਤਾ ਮੈਂ ਮੈਂ ਹੁਣ ਇੱਥੇ ਨਿਊਪੋਟ ਬਣਿਆ ਜਿਹੜਾ ਉੱਥੇ ਰੂਮ ਲਿਆ ਰੈਂਟ 'ਤੇ ਹਾਂਜੀ ਹਾਂਜੀ ਔਨਲਾਈਨ ਅਵੇਲੇਬਲ ਔਨਲਾਈਨ ਅਵੇਲੇਬਲ ਹੈ ਮੈਨਿਊ ਹਾਂਜੀ ਓਕੇ ਓਕੇ ਓਕੇ ਓਕੇ ਤੁਸੀਂ ਕਿੱਥੇ ਰਹਿੰਦੇ ਅੱਛਾ ਨਹੀਂ ਨਹੀਂ ਕੁਛ ਨਹੀਂ ਹਾਂਜੀ ਮੈਂ ਓਦਾਂ ਤਾਂ ਬੀਕੌਮ ਕਰਦੀ ਹਾਂ ਜਲੰਧਰ ਹੀ ਅਤੇ ਮੈਂ ਫ ਵਲੋਗਰ ਵੀ ਹਾਂ ਮਤਲਬ ਅਤੇ ਮੈਂ ਅਲੱਗ ਅਲੱਗ ਜਗ੍ਹਾ ਜਾਂਦੀ ਹੁੰਦੀ ਹਾਂ ਅਤੇ ਉਹਦੇ ਬਾਰੇ ਮਤਲਬ ਜੋ ਫੇਮਸ ਹੁੰਦਾ ਉਥੇ ਅਤੇ ਉਹ ਵਲੋਗ ਸ਼ੂਟ ਕਰਦੀ ਹਾਂ ਹਾਂਜੀ ਹਾਂਜੀ ਹਾਂਜੀ ਹੁਸ਼ਿਆਰਪੁਰ ਪਹਿਲੀ ਵਾਰ ਆਏ ਹਾਂ ਮੈਂ ਮਤਲਬ ਬੇ ਬੇਸਿਕਲੀ ਤਾਂ ਮੈਂ ਜਲੰਧਰ ਤੋਂ ਹਾਂ ਚੰਡੀਗੜ੍ਹ ਗਈ ਹਾਂ ਲੁਧਿਆਣੇ ਫਗਵਾੜੇ ਹਾਂਜੀ ਹਾਂਜੀ ਹਾਂਜੀ ਹੁਸ਼ਿਆਰਪੁਰ ਫਸਟ ਟਾਈਮ 'ਚ ਤੁਹਾਡਾ ਕੋਂਟੈਕਟ ਮੈਨੂੰ ਅਵੇਲੇਬਲ ਹੋਇਆ ਫਿਰ ਮੈਂ ਤੁਹਾਨੂੰ ਕੋਂਟੈਕਟ ਕੀਤਾ ਹਾਂਜੀ ਅਤੇ ਫੇਮਸ ਢਾਬਾ ਅੱਛਾ ਅਤੇ ਹਾਂਜੀ ਹਾਂਜੀ ਤੁਸੀਂ ਕੀ ਕਰਦੇ ਅੱਛਾ ਅੱਛਾ ਤੁਸੀਂ ਵੀ ਇੱਥੇ ਜਾਂਦੇ ਹੁੰਦੇ ਖਾਣ ਪ੍ਰਕਾਸ਼ ਢਾਬਾ ਅੱਛਾ ਅੱਛਾ ਫਰੈਸ਼ ਹੈ ਹੈ ਨਾ ਅੱਛਾ ਅੱਛਾ ਨੋਨ ਵੈਜ ਵੈਜ ਦੋਨੋਂ ਹੀ ਆ ਵੈਜ ਨੋਨ ਵੈਜ ਅੱਛਾ ਪਿਓਰ ਵੈਜ ਆ ਚਲੋ ਫਿਰ ਜਾਵਾਂਗੇ ਆਪਾਂ ਵਿਜ਼ਿਟ ਕਰਾਂਗੇ ਹਾਂਜੀ ਓਕੇ ਓਕੇ ਬਾਏ